ਹਾਂਜੀ ਜੇ ਪਿੰਡ ਵਿੱਚ ਕਿਸੇ ਵਿਅਕਤੀ ਨੂੰ ਸੱਪ ਨੇ ਡੰਗ ਮਾਰ ਦਿੱਤਾ ਹੋਵੇ ਤਾਂ ਅਸੀਂ ਸਭ ਤੋਂ ਪਹਿਲਾਂ ਉਸ ਜਗ੍ਹਾ 'ਤੇ ਕੱਪੜਾ ਬੰਨ੍ਹ ਦਿੰਦੇ ਹਾਂ ਜਿੱਥੇ ਸੱਪ ਨੇ ਡੰਗ ਮਾਰਿਆ ਹੋਵੇ ਤਾਂ ਕਿ ਪੂਰੇ ਸਰੀਰ ਵਿੱਚ ਜ਼ਹਿਰ ਨਾ ਫੈਲੇ ਅਤੇ ਫਿਰ ਸਾਡੇ ਪਿੰਡਾਂ ਵਿੱਚ ਜੋਗੀ ਆਉਂਦੇ ਹਨ ਅਤੇ ਉਹਨਾਂ ਦੇ ਕੋਲ ਨੀਲੇ ਰੰਗ ਦੀ ਮਣੀ ਹੁੰਦੀ ਹੈ ਮੋਤੀ ਹੁੰਦਾ ਹੈ ਜਿਹਦੇ ਨਾਲ ਉਹ ਮਣੀ ਜਿੱਥੇ ਸੱਪ ਨੇ ਡੰਗਿਆ ਹੋਵੇ ਉੱਥੇ ਲਗਾ ਕੇ ਜ਼ਹਿਰ ਨੂੰ ਚੂਸ ਲੈਂਦੇ ਹਨ ਅਤੇ ਜ਼ਿਆਦਾਤਰ ਜਾਂ ਫਿਰ ਜ਼ਿਆਦਾਤਰ ਜਿੱਥੇ ਸੱਪ ਨੇ ਡੰਗਿਆ ਹੋਵੇ ਉਥੇ ਕੱਟ ਲਾ ਕੇ ਖੂਨ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਕਿ ਹੋਸਪਿਟਲ ਜਾਣ ਤੱਕ ਇਹ ਕਿਸੇ ਵਿਅਕਤੀ ਨੂੰ ਜ਼ਹਿਰ ਨਾ ਫੈਲੇ ਅਤੇ ਜਾਂ ਫਿਰ ਅਸੀਂ ਜ਼ਿਆਦਾਤਰ ਸਾਡੇ ਪਿੰਡਾਂ ਵਿੱਚ ਕਈ ਲੋਕ ਮੂੰਹ ਦੇ ਨਾਲ ਜ਼ਹਿਰ ਚੂਸ ਕੇ ਅਤੇ ਸੱਪ ਦਾ ਜ਼ਹਿਰ ਕੱਢ ਦਿੰਦੇ ਹਨ ਅਤੇ ਜਾਂ ਫਿਰ ਅਸੀਂ ਜਿਹੜੇ ਜਿਸ ਵਿਅਕਤੀ ਨੂੰ ਸੱਪ ਨੇ ਡੰਗਿਆ ਹੋਵੇ ਉਸਨੂੰ ਨਮਕ ਨਹੀਂ ਦੇਣਾ ਚਾਹੀਦਾ ਅਤੇ ਜਾਂ ਫਿਰ ਅਸੀਂ ਜਿਹੜੇ ਵਿਅਕਤੀ ਨੂੰ ਸੱਪ ਨੇ ਡੰਗਿਆ ਹੋਵੇ ਉਹਨੂੰ ਅਸੀਂ ਹੋਸਪਿਟਲ ਵੀ ਲੈ ਜਾ ਸਕਦੇ ਹਾਂ ਅਤੇ ਜਾਂ ਫਿਰ ਅਸੀਂ ਦਵਾਈਆਂ ਦੇ ਸਕਦੇ ਹਾਂ ਕਿ ਤਾਂ ਕਿ ਜਿਸ ਵਿਅਕਤੀ ਨੂੰ ਸੱਪ ਨੇ ਡੰਗਿਆ ਹੈ ਜ਼ਹਿਰ ਨਾ ਫੈਲੇ